ਮੈਂ ਗੁਰਦਾਸਪੁਰ ਤੋਂ ਹਰਜੀਤ ਕੌਰ ਬੋਲਦੀ ਪਈ ਆਂ ਸਾਸਰੀ ਕਾਲ ਮੇਰਾ ਸ ਸਵੇਰ ਦਾ ਕੰਮ ਹੈਗਾ ਵਾ ਪਹਿਲਾਂ ਦਿਨਚਰਿਆ ਮੇਰੀ ਹੈਗੀ ਐ ਕੀ ਯੋਗਾ ਸਭ ਤੋਂ ਪਹਿਲਾਂ ਉੱਠ ਕੇ ਯੋਗਾ ਕਰਨਾ ਯੋਗਾ ਕਰਕੇ ਆਪਣਾ ਮਤਲਬ ਕੀ ਫੇਰ ਯੋਗਾ ਕਰਕੇ ਫਿਰ ਮੈਂ ਨੌਣ ਦਾ ਧੋਣ ਦਾ ਕੰਮ ਕਰਕੇ ਰਸੋਈ ਵਿੱਚ ਜਾ ਕੇ ਫੇਰ ਆਪਣਾ ਕੰਮ ਕਾਰ ਸ਼ੁਰੂ ਕਰ ਦਿੰਨੀ ਆਂ ਪਹਿਲਾਂ ਯੋਗਾ ਸ਼ੁਰੂ ਕਰਨ ਤੋਂ ਪਹਿਲਾਂ ਪਹਿਲਾਂ ਮੈਂ ਇੱਕ ਯੋਗਾ ਕਰਨੀ ਆਂ ਲੋਟਸ ਜਿਹੜਾ ਸ਼ਾਂਤੀ ਨਾਲ ਬੈਠ ਕੇ ਜਿਹੜਾ ਮਤਲਬ ਕੀ ਕਰਨਾ ਹੁੰਦਾ ਵਾ ਉਹਤੋਂ ਬਾਦਾਂ ਫਿਰ ਮੈਂ ਹੀਰੋ ਆਸਣ ਕਰਦੀ ਆਂ ਇਹ ਸਿੱਧੇ ਲੱਕ ਕਰਕੇ ਗੋਡੇ ਪਿੱਛੇ ਫੋਲਡ ਕਰਕੇ ਕਰਨਾ ਹੁੰਦਾ ਹੈ ਮੁੜ ਕੇ ਮੈਂ ਪਦਮ ਆਸਣ ਕਰਦੀ ਆਂ ਜਿਹਦੇ ਦੇ ਨਾਲ ਮੇਰਾ ਸ਼ਰੀਰ ਜਿਹੜਾ ਤੰਦਰੁਸਤ ਫਸਕਲਾਸ ਵਧੀਆ ਰਹਿੰਦਾ ਵਾ ਉਹ ਤੋਂ ਬਾਦੋਂ ਮੈਂ ਥੋੜ੍ਹਾ ਜਿਹਾ ਦੰਦਰ ਆਸਣ ਕਰਦੀ ਆਂ ਜੋ ਲੰਮੇ ਪੈ ਕੇ ਪੈਰਾਂ ਨੂੰ ਫੜ ਕੇ ਧੋਣ ਧੌਣ ਚੁੱਕਣ ਵਾਲਾ ਜਿਹੜਾ ਹੁੰਦਾ ਸ਼ੈਲ ਸ਼ਵ ਆਸਣ ਕਰਦੀ ਆਂ ਜਿਹੜਾ ਹੈਗਾ ਵਾ ਸ਼ਵ ਆਸਣ ਪੈਰਾਂ ਦੇ ਨਾਲ ਪੈਰ ਜੋੜ ਕੇ ਲੱਤਾਂ ਨੂੰ ਹਲਾਉਣ ਦਾ ਕੰਮ ਫੇਰ ਇਹ ਸਾਰਾ ਕੰਮ ਕਰਕੇ ਥੋੜਾ ਜਿਆ ਗਲੀ ਦੇ ਵਿੱਚ ਸੈਰ ਸਪਾਟਾ ਵੀ ਥੋੜਾ ਜਿਆ ਸਵੇਰੇ ਸਵੇਰੇ ਤਾਜ਼ੀ ਹਵਾ ਵਾਸਤੇ ਉਹ ਵੀ ਕਰ ਕਰੀ ਦਾ ਹੈਗਾ ਵਾ ਉਹਤੋਂ ਬਾਦਾਂ ਫੇਰ ਮੇਰਾ ਘਰ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਕੀ ਰਸੋਈ ਵਿੱਚ ਜਾਣਾ ਰਸੋਈ ਵਿੱਚ ਜਾ ਕੇ ਆਪਣੇ ਬੱਚਿਆਂ ਲਈ ਖਾਣਾ ਬਣਾਉਣਾ ਮੇਰੇ ਘਰ ਵਾਲੇ ਦੀ ਤਬੀਅਤ ਥੋੜੀ ਜਿਹੀ ਖਰਾਬ ਹੈਗੀ ਐ ਉਨ੍ਹਾਂ ਨੂੰ ਸਾਂਭ ਸੰਭਾਲ ਕਰਨੀ ਉਨ੍ਹਾਂ ਦਾ ਜੋ ਵੀ ਉਨ੍ਹਾਂ ਨੇ ਖਾਣਾ ਪੀਣਾ ਉਨ੍ਹਾਂ ਦਾ ਬਣਾਣਾ ਫੇਰ ਬੱਚਿਆਂ ਨੂੰ ਕੰਮ ਕਾਰ ਤੇ ਭੇਜਣਾ ਫੇਰ ਜਾ ਕੇ ਆਪਣਾ ਥੋੜਾ ਜਾਂ ਕਈ ਕੰਮ ਵਗੈਰਾ ਜੋ ਵੀ ਹੈ ਕਰਨਾ ਸਾਰੀ ਦਿਹਾੜੀ ਮਤਲਬ ਕੀ ਜਿਹੜਾ ਸ਼ਰੀਰ ਆ ਉਹ ਹਸਤ ਹਸਤ ਰਹਿੰਦਾ ਵਾ ਚੁਸਤ ਰਹਿੰਦਾ ਵਾ ਸਾਰੇ ਕੰਮ ਦੇ ਵਿੱਚ ਕੋਈ ਰੁਕਾਵਟ ਨੀ ਆਉਂਦੀ ਹੈਗੀ ਇਹ ਸਾਡਾ ਅਭਿਆਸ ਹੀ ਹੋ ਗਿਆ ਕੀ ਅਸੀਂ ਜਿਹੜਾ ਕੰਮ ਕਰਨਾ ਵਾ ਸਵੇਰੇ ਉੱਠ ਕੇ ਯੋਗਾ ਕਰਕੇ ਉਹ ਤੋਂ ਬਾਦਾਂ ਸਾਰਾ ਹੀ ਕੰਮ ਅਹੀਂ ਕਰਨਾ ਪੈਂਦਾ ਹੈਗਾ ਵਾ ਸਾਨੂੰ ਤੇ